ਹੈਲੋ ਵਧੀਆ ਜੀ ਹਾਂਜੀ ਨਿਰੰਜਣ ਬੋਲ ਰਿਹਾਂ ਤੁਸੀਂ ਕੌਣ ਹਾਂਜੀ ਅੱਛਾ ਜੀ ਮੁਬਾਰਕਾਂ ਜੀ ਤੁਹਾਨੂੰ ਹਾਂਜੀ ਠੀਕ ਹੈ ਜੀ ਹਾਂਜੀ ਤੁਸੀਂ ਤੁਸੀਂ ਮੈਂ ਕਿਹਾ ਬਲਾਚੌਰ ਵਿਖੇ ਆਏ ਕਦੇ ਬਲਾਚੌਰ ਵੱਲ ਆਏ ਤੁਸੀਂ ਨਾ ਅੰਮ੍ਰਿਤਸਰ ਜਾ ਸਕਦੇ ਆ ਅੰਮ੍ਰਿਤਸਰ ਗੋਲਡਨ ਟੈਂਪਲ ਹੈਗਾ ਹਾਂਜੀ ਉਥੇ ਜਾ ਆਇਓ ਬਾਗਾ ਬਾਡਰ ਆ ਉਥੇ ਪੰਜਾਬ ਅਤੇ ਜਿਹੜੇ ਪਾਕਿਸਤਾਨ ਦਾ ਬੋਡਰ ਹੈ ਜੀ ਉੱਥੇ ਬਾਗਾ ਬਾਡਰ ਰਾਜਾ ਸਾਹਿਬ ਜਾ ਆਇਓ ਰਾਜਾ ਸਾਹਿਬ ਮਜਾਰੀ ਨਵਾ ਸ਼ਹਿਰ ਅਨੰਦਪੁਰ ਸਾਹਿਬ ਜਾ ਆਇਓ ਜੀ ਹਾਂਜੀ ਪਰਿਵਾਰਿਕ ਜਗ੍ਹਾ ਏ ਸਰ ਤੁਹਾਨੂੰ ਬਹੁਤ ਵਧੀਆ ਲੱਗੁਗਾ ਜਦ ਘੁੰਮ ਕੇ ਆਓਂਗੇ ਜਦੋਂ ਤੁਸੀਂ ਤੁਹਾਨੂੰ ਮੈਂ ਹਰੇਕ ਜਗ੍ਹਾਵਾਂ ਜਿੱਥੇ ਤੁਸੀਂ ਜਾਓਂਗੇ ਤੁਹਾਨੂੰ ਨਾਲ ਨੇ ਤੇਰੇ ਪੀ ਜੀ ਹੈਗੇ ਆ ਹੋਸ ਹੋਟਲ ਹੈਗੇ ਤੁਸੀਂ ਉਥੇ ਰੁਕ ਸਕਦੇ ਫੈਮਿਲੀ ਨਾਲ ਰਹਿਣਾ ਤੁਹਾਨੂੰ ਕਿਸੇ ਗੱਲ ਦੀ ਔਖੀ ਨਹੀਂ ਹੋਣੀ ਬਾਕੀ ਤੁਸੀਂ ਮੈਨੂੰ ਫੋਨ ਕਰ ਲਿਓ ਜੇ ਤੁਸੀਂ ਆਏ ਇਧਰ ਨੂੰ ਮੇਰਾ ਮੇਰੇ ਘਰੇ ਉਰੇ ਹੈ ਆ ਜੀ ਹਾਂਜੀ ਬੇਸ਼ੱਕ ਜਦ ਮਰਜ਼ੀ ਫੋਨ ਕਰ ਲਿਓ ਤੁਸੀਂ ਮੈਨੂੰ ਕਿਸੇ ਔਖੀ ਨਹੀਂ ਹੈਗੀ ਓਕੇ